ਸਾਡੇ ਭਾਰਤ ਦੇ ਹੀ ਯੋਗ ਗੁਰੂ ਬਾਬਾ ਰਾਮਦੇਵ ਜੀ ਜਿਹਨਾਂ ਦਾ ਅਸਲੀ ਨਾਮ ਠਾਕੁਰ ਬ੍ਰਹਮ ਕਿਸ਼ਨ ਜੀ ਹਨ ਅਤੇ ਉਹਨਾਂ ਦਾ ਜਨਮ ਪੱਚੀ ਦਸੰਬਰ ਉੱਨੀ ਸੌ ਪੈਂਹਠ ਵਿੱਚ ਹੋਇਆ ਹੈ ਉਹ ਹਾਲੇ ਸੱਠ ਸਾਲ ਦੀ ਉਮਰ ਵਿੱਚ ਵੀ ਹੋ ਕੇ ਇੰਨੇ ਤੰਦਰੁਸਤ ਹਨ ਕਿ ਉਹਨਾਂ ਨੂੰ ਦੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਕਿ ਉਹ ਸੱਠ ਸਾਲ ਦੇ ਹੋ ਗਏ ਹਨ ਅਤੇ ਮੈਂ ਉਹਨਾਂ ਨੂੰ ਵੇਖਦੀ ਹਾਂ ਉਹ ਥਾਂ ਥਾਂ ਜਾ ਕੇ ਆਪਣਾ ਯੋਗ ਆਯੋਜਿਤ ਕਰਦੇ ਹਨ ਥਾਂ ਥਾਂ ਜਗ੍ਹਾ ਜਾ ਕੇ ਦੁਨੀਆਂ ਆਉਂਦੀ ਹੈ ਉਹਨਾਂ ਨੂੰ ਵੇਖਦੀ ਹੈ ਉਹਨਾਂ ਨੂੰ ਤੋਂ ਪ੍ਰੇਰਿਤ ਹੋ ਕੇ ਉਹ ਯੋਗਾ ਕਰਦੀ ਹੈ ਅਤੇ ਮੈਂ ਵੀ ਉਹਨਾਂ ਤੋਂ ਬਹੁਤ ਪ੍ਰੇਰਿਤ ਹੋਈ ਹਾਂ ਮੈਂ ਉਹਨਾਂ ਦੇ ਵੱਲੋਂ ਦੱਸੇ ਗਏ ਹਰ ਇੱਕ ਯੋਗ ਕੀਤਾ ਹੈ ਔਰ ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਉਹਨਾਂ ਦੇ ਯੋਗਾ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਜਿਸ ਵੇਲੇ ਉਹ ਨਹੀਂ ਸਾਡੇ ਸ਼ਹਿਰ ਵਿੱਚ ਆਉਂਦੇ ਆਯੋਜਿਤ ਕਰਨ ਅਤੇ ਉਹ ਟੀ ਵੀ ਵਿੱਚ ਵੀ ਬਹੁਤ ਆਉਂਦੇ ਹਨ ਟੀ ਵੀ ਤੋਂ ਵੇਖ ਕੇ ਜਿਹੜੀ ਜਨਤਾ ਨਹੀਂ ਉਹਨਾਂ ਦੇ ਆਯੋਜਿਤ ਵਿੱਚ ਜਾ ਸਕਦੀ ਉਹ ਟੀ ਵੀ ਵਿੱਚ ਵੇਖ ਕੇ ਘਰੇ ਹੀ ਯੋਗ ਕਰਦੇ ਹਨ ਅਤੇ ਉਹਨਾਂ ਨੇ ਬਹੁਤ ਜੀਆਂ ਇੱਦਾਂ ਦੀਆਂ ਆਮ ਘਰੇਲੂ ਦਵਾਈਆਂ ਬਣਾਈਆਂ ਹਨ ਜਿੱਦਾਂ ਸ਼ੂਗਰ ਦੀਆਂ ਬੀ ਪੀ ਦੀਆਂ ਬਵਾਸੀਰ ਦੀਆਂ ਅਤੇ ਹੋਰ ਵੀ ਬਹੁਤ ਇੱਦਾਂ ਦੇ ਬਿਮਾਰੀਆਂ ਦਾ ਉਹਨਾਂ ਨੇ ਘਰੇਲੂ ਇਲਾਜ ਦੱਸਿਆ ਹੈ ਜੋ ਕਿ ਸ਼ਾਇਦ ਹੀ ਡਾਕਟਰ ਦੱਸਣਗੇ ਉਹ ਬਹੁਤ ਹੀ ਵੱਡੇ ਔਰ ਪੂਰੇ ਭਾਰਤ ਅਤੇ ਵਿਦੇਸ਼ ਵਿੱਚ ਵੀ ਇੰਨੇ ਹੀ ਜ਼ਿਆਦਾ ਪ੍ਰਸਿੱਧ ਹਨ ਕਿ ਵਿਦੇਸ਼ ਦੇ ਲੋਕ ਵੀ ਉਹਨਾਂ ਤੋਂ ਦੇ ਕੇ ਬਹੁਤ ਹੀ ਪ੍ਰੇਰਿਤ ਹੁੰਦੇ ਹਨ ਮੈਂ ਸਮੇਂ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵੇਖਦੀ ਹਾਂ